ਸਾਡੇ ਖੇਤਰ ਵਿੱਚ ਜੇਕਰ ਕੀਤੀਆਂ ਜਾਣ ਤਾਂ ਸਿਹਤ ਪ੍ਰਤੀ ਕੌਂਸ਼ੀਅਸਨੈਸ ਦੇ ਸੈਂਟਰ ਸਥਾਪਿਤ ਕੀਤੇ ਜਾ ਸਕਦੇ ਹਨ ਕਿਉਂਕਿ ਲੋਕਾਂ ਨੂੰ ਅੱਜ ਕੱਲ੍ਹ ਇਸ ਚੀਜ਼ ਦਾ ਗਿਆਨ ਹੀ ਨਹੀਂ ਹੈ ਕਿ ਕਿਹੜੀ ਚੀਜ਼ ਕਿਸ ਸਮੇਂ ਖਾਣੀ ਚਾਹੀਦੀ ਹੈ ਜ਼ਿਆਦਾ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਦੂਜਾ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਜੇਕਰ ਮੈਂ ਕਾਰੋਬਾਰ ਸ਼ੁਰੂ ਕਰਨਾ ਚਾਹਾਂ ਤਾਂ ਮੈਂ ਮੋਟੀਵੇਸ਼ਨਲ ਗਾਈਡੈਂਸ ਸੈਂਟਰ ਸਥਾਪਿਤ ਕਰਨਾ ਚਾਹੂੰਗੀ ਕਿਉਂਕਿ ਅੱਜ ਕੱਲ੍ਹ ਦੇ ਯੂਥ ਨੂੰ ਇਸ ਬਾਰੇ ਨੋਲੇਜ ਹੀ ਨਹੀਂ ਹੈਗੀ ਉਹ ਬਹੁਤ ਜ਼ਿਆਦਾ ਕਨਫਿਊਜ਼ ਰਹਿੰਦੇ ਹਨ ਕਿ ਉਹ ਭਵਿੱਖ ਵਿੱਚ ਕਿਹੜਾ ਵਿਸ਼ਾ ਚੂਜ਼ ਕਰਨ ਕਿਹੜੇ ਵੱਲ ਨੂੰ ਜਾਣ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਜਿਸ ਕਰਕੇ ਉਹ ਪਿਛੜੇ ਹੀ ਰਹਿ ਜਾਂਦੇ ਹਨ ਉਹ ਗਲਤ ਰਸਤਾ ਚੂਜ਼ ਕਰਦੇ ਹਨ ਉਸ ਵਿੱਚ ਸਮਾਂ ਬਰਬਾਦ ਕਰਦੇ ਹਨ ਫਿਰ ਵਾਪਸ ਤੋਂ ਮੁੜ ਕੇ ਆਉਂਦੇ ਹਨ ਪਰ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ ਸਕੂਲਾਂ ਅਤੇ ਕਾਲਜ ਲੈਵਲ ਦੇ ਉੱਤੇ ਸੋ ਮੈਂ ਜੇ ਆਪਣੇ ਪ ਏਰੀਏ ਵਿੱਚ ਕਰਨਾ ਚਾਹਾਂ ਤਾਂ ਮੈਂ ਗਾਈਡੈਂਸ ਮੋਟੀਵੇਸ਼ਨ ਸੈਂਟਰ ਸਥਾਪਿਤ ਕਰਨਾ ਚਾਹੂੰਗੀ